ਇੱਕ ਵਾਰ ਦੀ ਗੱਲ ਹੈ ਅਸੀਂ ਸਲਾਹ ਕਰਕੇ ਔਨਲਾਈਨ ਕੁਰਸੀਆਂ ਦੀ ਖਰੀਦਦਾਰੀ ਕੀਤੀ ਕੁਰਸੀਆਂ ਔਨਲਾਈਨ ਮੰਗਾਉਣ ਕਾਰਨ ਸਾਨੂੰ ਜਿਹੜੇ ਕੌੜੇ ਤਜਰਬਿਆਂ ਵਿੱਚੋਂ ਨਿਕਲਣਾ ਪਿਆ ਉਹ ਇਹ ਸਨ ਕਿ ਇੱਕ ਤਾਂ ਉਹ ਦਿੱਤੇ ਸਮੇਂ ਤੋਂ ਘਰ ਲੇਟ ਪਹੁੰਚੀਆਂ ਇਸ ਕਰਕੇ ਸਾਨੂੰ ਇਹ ਵੀ ਦਿੱਕਤ ਆਈ ਉਸ ਤੋਂ ਬਾਅਦ ਉਸ ਦੀ ਜਿਹੜੀ ਪਲਾਸਟਿਕ ਦੀ ਕਿਸਮ ਸੀ ਉਹ ਬਾਹਲੀ ਸੋਹਣੀ ਵਧੀਆ ਨਹੀਂ ਸੀ ਜਿਸ ਕਰਕੇ ਉਹ ਮਤਲਬ ਬੈਠਦੇ ਸੀ ਜਦੋਂ ਤਾਂ ਉਹ ਝੁਕ ਜਾਂਦੀਆਂ ਸੀ ਉਹਦੀਆਂ ਲੱਤਾਂ ਜਿਹੜੀਆਂ ਕੁਰਸੀ ਦੀਆਂ ਲੱਤਾਂ ਸੀ ਉਹ ਮੁੜਨੀਆਂ ਸ਼ੁਰੂ ਹੋ ਗਈਆਂ ਅਤੇ ਬਹੁਤ ਜਲਦੀ ਉਹ ਕੁਰਸੀਆਂ ਖਰਾਬ ਹੋ ਗਈਆਂ ਚਾਰ ਕੁਰਸੀਆਂ ਦਾ ਸੈਟ ਸੀ ਉਹ ਸਾਡੇ ਜਿੰਨੇ ਪੈਸੇ ਲੱਗੇ ਉਨ੍ਹਾਂ ਉਹਨਾਂ ਨੇ ਸਾਨੂੰ ਨਹੀਂ ਦਿੱਤਾ ਹੈਗਾ ਰਿਜਲਟ ਉਹ ਬਹੁਤ ਵਧੀਆ ਨਹੀਂ ਸੀ ਇਸ ਕਰਕੇ ਔਨਲਾਈਨ ਜਿਹੜੀ ਖਰੀਦਦਾਰੀ ਕੀਤੀ ਗਈ ਸੀ ਉਸ ਮੁਤਾਬਕ ਮੇਰਾ ਇਕ ਤਜਰਬਾ ਰਿਹਾ ਹੈ ਵੀ ਉਹ ਠੀਕ ਨਹੀਂ ਸੀ ਇਸ ਕਰਕੇ ਜੇ ਤੁਸੀਂ ਕੁਝ ਖਰੀਦਣਾ ਚਾਹੁੰਦੇ ਹੋ ਤਾਂ ਆਪ ਖਰੀਦੋ ਔਨਲਾਈਨ ਤੁਹਾਨੂੰ ਫੋਟੋਆਂ ਦਿਖਾ ਦਿੱਤੀਆਂ ਜਾਂਦੀਆਂ ਹਨ ਜਿਸਕਾ ਕੋਈ ਦਿਖਾਉਣ ਵਿੱਚ ਹੋਰ ਅਤੇ ਘਰੇ ਪਹੁੰਚਣ ਵਿੱਚ ਹੋਰ ਹੁੰਦੀਆਂ ਹਨ